ਸਤਿ ਸ਼੍ਰੀ ਅਕਾਲ ਸਰ ਮੈਂ ਦੇਸ ਰਾਜ ਬੋਲਦਾ ਹੂੰ ਪਠਾਨਕੋਟ ਤੋਂ ਸਰ ਮੈਂ ਤੁਹਾਨੂੰ ਆਪਣੇ ਪੰਜਾ ਮੈਂ ਘੁੰਮਣ ਜਾ ਰਿਹਾ ਹੂੰ ਮੈਂ ਆਪਣੇ ਪਠਾਨਕੋ ਪੰਜਾਬ ਬਾਰੇ ਦੱਸਣਾ ਚਾਹੁੰਦਾ ਹੂੰ ਮੈਂ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਹਰਿਮੰਦਰ ਸਾਹਿਬ ਜਲਿਆਂ ਵਾਲੇ ਬਾਗ ਅਟਾਰੀ ਬਾਰਡਰ ਵਾਹਗਾ ਬਾਰਡਰ ਸਾਨੂੰ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਇਹ ਜਗ੍ਹਾ ਬਹੁਤ ਹੀ ਪਸੰਦ ਪਸੰਦ ਹੈ ਸਾਨੂੰ ਇਹਨਾਂ ਜਗ੍ਹਾ ਤੋਂ ਸਾਨੂੰ ਬਹੁਤ ਬਹੁਤ ਸਾਨੂੰ ਆਪਣਾ ਪੰਜਾਬ ਦਾ ਵਾਤਾਵਰਣ ਬਹੁਤ ਚੰਗਾ ਲੱਗਦਾ ਹੈ ਇਸ ਕਰਕੇ ਸਾਨੂੰ ਇਹ ਪੰਜਾਬ ਦੇ ਵਿੱਚ ਰਹਿਣਾ ਹੀ ਬਹੁਤ ਪਸੰਦ ਹੈ ਇਸ ਕਰਕੇ ਸਾਨੂੰ ਪੰਜਾਬ ਦੀਆਂ ਬਹੁਤ ਹੀ ਅੱਛੀਆਂ ਚੀਜ਼ਾਂ ਖਾਣ ਪੀਣ ਵਾਸਤੇ ਸਾਨੂੰ ਪ੍ਰਾਪਤ ਹੁੰਦੀਆਂ ਨੇ ਇਸ ਕਰਕੇ ਸਾਨੂੰ ਪੰਜਾਬ ਦੇ ਰਹਿਣ ਸਹਿਣ ਦਾ ਪ੍ਰੋਗਰਾਮ ਵੀ ਅੱਛਾ ਮਿਲਦਾ ਹੈ ਇਸ ਕਰਕੇ ਸਾਨੂੰ ਪੰਜਾਬ ਦੇ ਕੱਪੜੇ ਲੀੜੇ ਵੀ ਬਹੁਤ ਵਧੀਆ ਵਧੀਆ ਤੋਂ ਵਧੀਆ ਹੀ ਪਸੰਦ ਲੱਗਦੇ ਹੈ ਸਾਨੂੰ ਆਪਣੇ ਪੰਜਾਬ ਦਾ ਗਿੱਧਾ ਔਰ ਭੰਗੜਾ ਬਹੁਤ ਹੀ ਵਧੀਆ ਪਸੰਦ ਲੱਗਦਾ ਹੈ ਇਸ ਕਰਕੇ ਸਾਨੂੰ ਪੰਜਾਬ ਦੀਆਂ ਹਰ ਤਰ੍ਹਾਂ ਦੀਆਂ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਸਹੂਲਤਾਂ ਮਿਲਦੀਆਂ ਨੇ ਹੈ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਰਹਿਣ ਸਹਿਣ ਦਾ ਬਹੁਤ ਹੀ ਅੱਛਾ ਅਤੇ ਵਧੀਆ ਪ੍ਰੋਗਰਾਮ ਲੱਗਦਾ ਹੈ